ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ

ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਜਾਂਦਾ ਹੋ ਜਾਂਦਾ ਵੀਰੇ ਤੁਸੀਂ ਆਪਣਾ ਹਾਂਜੀ ਹਾਂਜੀ ਵੀਰੇ ਤੁਸੀਂ ਆਪਣਾ ਦੱਸੁੰਗੇ ਵੇਟ ਕਿੰਨਾ ਤੁਹਾਡਾ ਹਾਈਟ ਸਾਢੇ ਸੱਤ ਕਿ ਅੱਠ ਹਾਈਟ ਹਾਈਟ ਵੀਰੇ ਪੂਰੀ ਪ੍ਰੋਪਰ ਦੱਸਣੀ ਪੈਂਦੀ ਠੀਕ ਹੈ ਵੀਰੇ ਅੱਠ ਇੰਚ ਬੜਾ ਘੱਟ ਹੈ ਵੀਰੇ ਅੱਛਾ ਜ਼ਿਆਦਾ ਹੀ ਪਤਲੇ ਹੋ ਚਲੋ ਕੋਈ ਨਾ ਵੇਟ ਗ਼ੈਨ ਦੇ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਹਾਂਜੀ ਵੀਰੇ ਤੁਸੀਂ ਕਿੰਨੇ ਕ ਵਜੇ ਆ ਜੂਗੇ ਇੱਧਰ ਜਿਮ ਫ਼ਿਰ ਜਿਮ ਕਿੰਨੇ ਵਜੇ ਆਉਂਗੇ ਸ਼ਿਫਟ ਤਾਂ ਦੱਸੋ ਕਿੰਨੇ ਵਜੇ ਆਉਂਗੇ ਤੁਸੀਂ ਅੱਛਾ ਚਲੋ ਹਾਂਜੀ ਸੱਤ ਨੌਂ ਠੀਕ ਹੈ ਵੀਰੇ ਅਤੇ ਆਪਣਾ ਤੁਸੀਂ ਜਦੋਂ ਆਉਗੇ ਨਾ ਪਹਿਲਾਂ ਆਪਾਂ ਨੇ ਕਰਨੀ ਹੈ ਕਾਰਡੀਓ ਠੀਕ ਹੈ ਵੀਰੇ ਹਾਂਜੀ ਕਾਰਡੀਓ ਉਹਦੇ ਵਿੱਚ ਅਤੇ ਹਾਂਜੀ ਹਾਂਜੀ ਵੀਰੇ ਉਹ ਆਪਣਾ ਹੁੰਦਾ ਪਹਿਲਾਂ ਨਾ ਸਟ੍ਰੈਚਿੰਗ ਵਗੈਰਾ ਹੁੰਦੀ ਹੈ ਪਿੱਛੇ ਉਹ ਟਿਊਨ ਸਾਊਂਡ ਟ੍ਰੈਕ ਲਾਇਆ ਲਾਉਂਦੇ ਹੈ ਥੋੜ੍ਹਾ ਮੋਟੀਵੇਸ਼ਨ ਵੀ ਹੁੰਦੀ ਹੈ ਅਤੇ ਉਹਦੇ ਨਾਲ ਤੁਸੀਂ ਪਹਿਲਾਂ ਸਟ੍ਰੈਚਿੰਗ ਵਗੈਰਾ ਕਰੁੰਗੇ ਅਤੇ ਵੋਕਿੰਗ ਵੀ ਪਹਿਲਾਂ ਤੁਹਾਡੇ ਤੋਂ ਕਰਾਵਾਂਗੇ ਟਰੈਡ ਮਿਲ ਵੀ ਕਰਵਾਵਾਂਗੇ ਸਾਈਕਲਿੰਗ ਵੀ ਅਤੇ ਬਾਅਦ ਵਿੱਚ ਹੈ ਨਾ ਫੇਰ ਅਸੀਂ ਗੇਮ ਵੀ ਸ਼ੁਰੂ ਕਰਾਂਗੇ ਵੇਟ ਗ਼ੈਨ ਦੀ ਐਕਸਰਸਾਈਜ਼ ਸ਼ੁਰੂ ਕਰਾਂਗੇ ਹਾਂਜੀ ਉਸ ਤੋਂ ਬਾਅਦ ਫ਼ੇਰ ਅਸੀਂ ਕਰਾਂਗੇ ਆਪਣਾ ਲੈੱਗ ਦੀ ਦੋ ਤਿੰਨ ਐਕਸਰਸਾਈਜ਼ ਕਰ ਲਾਂਗੇ ਠੀਕ ਹੈ ਪਰ ਨਾਲ਼ ਦੀ ਨਾਲ਼ ਤੁਹਾਨੂੰ ਡਾਇਟ ਫ਼ੋਲੋ ਕਰਨੀ ਪੈਣੀ ਹੈ ਕਿਉਂਕਿ ਡਾਇਟ ਤੋਂ ਬਗੈਰ ਇਕੱਲੀ ਐਕਸਰਸਾਈਜ਼ ਨਾਲ ਨਹੀਂ ਕੁਛ ਹੋਣਾ ਹਾਂਜੀ ਦੇਖੋ ਤੁਸੀਂ ਹੁਣ ਕੀ ਖਾਨੇ ਹੁੰਨੇ ਓਂ ਨੌਰਮਲ ਤੁਹਾਡੀ ਰੁਟੀਨ ਡਾਈਟ ਕੀ ਹੈ ਅੱਛਾ ਤਾਂ ਹੀ ਵੀਰੇ ਵੇਟ ਘੱਟ ਹੈ ਤੁਹਾਡਾ ਤੁਸੀਂ ਓ ਰੋਟੀ ਇਕੱਲੀ ਖਾਨੇ ਹੋ ਫਰੂਟਸ ਵਗੈਰਾ ਕੁਛ ਹਾਂਜੀ ਤੁਸੀਂ ਦੇਖੋ ਸਵੇਰੇ ਕਿੰਨੇ ਵਜੇ ਉੱਠ ਜਾਨੇ ਤੁਸੀਂ ਠੀਕ ਹੈ ਅਤੇ ਤੁਸੀਂ ਫ਼ੇਰ ਉੱਠੂੰਗੇ ਨਾ ਨਾਲ ਹੀ ਪਹਿਲਾਂ ਗਰਮ ਪਾਣੀ ਪੀਓ ਠੀਕ ਹੈ ਅਤੇ ਥੋੜ੍ਹਾ ਕੁਛ ਖਾਣ ਪੀਣ ਲਈ ਜਿਵੇਂ ਬੋਆਇਲਡ ਪਟੈਟੋ ਖਾ ਲਿਆ ਥੋੜ੍ਹਾ ਦਹੀਂ ਦਹੀਂ ਬੋਆਇਲਡ ਪਟੈਟੋ ਕਰਕੇ ਮੈਸ਼ ਪਟੈਟੋ ਖਾ ਲਏ ਅਤੇ ਥੋੜ੍ਹੀ ਫ਼ਿਰ ਵਾਕਿੰਗ ਕਰਿਓ ਹਾਂਜੀ ਮਤਲਬ ਓਹੀ ਰਨਿੰਗ ਵਗੈਰਾ ਸਵੇਰੇ ਸਵੇਰੇ ਹਾਂਜੀ ਹਾਂਜੀ ਜੋਗਿੰਗ ਅਤੇ ਉਸ ਤੋਂ ਬਾਅਦ ਫ਼ਿਰ ਬਨਾਨਾ ਸ਼ੇਕ ਪੀ ਲਿਆ ਠੀਕ ਹੈ ਵੀਰੇ ਹਾਂਜੀ ਅਤੇ ਫ਼ੇਰ ਤੁਸੀਂ ਆਪਣਾ ਰੋਟੀ ਪਾਣੀ ਜਿਹੜਾ ਖਾਨੇ ਓ ਉਹ ਖਾਈਓ ਜੋ ਤੁਸੀਂ ਨੌਰਮਲ ਸਵੇਰੇ ਖਾਨੇ ਹੋ ਉਸ ਤੋਂ ਪਹਿਲਾਂ ਆਹ ਚੀਜ਼ ਕਰਨੀ ਆ ਫ਼ੇਰ ਤੁਸੀਂ ਬ੍ਰੇਕ ਟਾਈਮ ਤੁਹਾਡਾ ਹੁੰਦਾ ਤੁਸੀਂ ਮਤਲਬ ਦੁਪਹਿਰ ਕ ਨੂੰ ਕੁਛ ਖਾਨੇ ਹੋ ਹਾਂਜੀ ਉਹ ਰੋਟੀ ਤੋਂ ਪਹਿਲਾਂ ਤਾਂ ਤੁਸੀਂ ਖਾਣੇ ਸਪਰਾਊਟਸ ਸਪਰਾਊਟ ਵੀਰੇ ਸਪਰਾਊਟ ਚਨੇ ਚਨੇ ਵੀਰੇ ਚਨੇ ਭੰਗੋਏ ਹੋਏ ਚਨੇ ਹਾਂਜੀ ਖੀਰਾ ਕੱਟ ਲੈਣਾ ਖੀਰਾ ਕੱਟ ਲਿਆ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਨਿੰਬੂ ਪਾ ਲਿਆ ਵਿੱਚ ਠੀਕ ਹੈ ਵੀਰੇ ਥੋੜ੍ਹਾ ਸਪਰਾਊਟਸ ਥੋੜ੍ਹਾ ਟੇਸਟੀ ਜਿਹਾ ਬਣ ਜੂਗਾ ਉਹ ਕਰ ਲਿਆ ਫ਼ੇਰ ਤੁਸੀਂ ਹੈਲੋ ਹਾਂਜੀ ਹਾਂਜੀ ਉਹ ਕਰ ਲਿਆ ਤੁਸੀਂ ਨੌਨ ਵੇਜ ਖਾਨੇ ਹੋ ਕੀ ਵੇਜ ਹਾਂਜੀ ਵੀਰੇ ਦੇਖੋ ਦੋ ਆਂਡੇ ਦੁਪਹਿਰ ਦੇ ਖਾ ਲਈਓ ਤੁਸੀਂ ਉਬਲੇ ਹੋਏ ਠੀਕ ਹੈ ਸ਼ਾਮ ਨੂੰ ਦੋ ਆਂਡੇ ਖਾ ਲੈ ਠੀਕ ਹੈ ਵੀਰੇ ਅਤੇ ਫੇਰ ਜਦੋਂ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਕਰ ਲੀਓ ਮੇਰੇ ਖ਼ਿਆਲ ਨਹੀਂ ਰੋਟੀ ਖਾਣ ਤੋਂ ਬਾਅਦ ਤੁਸੀਂ ਫਰੂਟਸ ਵਗੈਰਾ ਫਲੂ ਫਰੂਟ ਸੈਲਿਡ ਖਾ ਲੀਓ ਠੀਕ ਹੈ ਹਾਂਜੀ ਅਤੇ ਇੱਕ ਚੀਜ਼ ਹੋਰ ਦੁਪਹਿਰੇ ਜਦੋਂ ਹੈਲੋ ਦੁਪਹਿਰੇ ਤੁਸੀਂ ਨਾ ਆਪਣਾ ਜਿਹੜੇ ਤੁਸੀਂ ਸਪਰਾਊਟਸ ਖਾਣੇ ਹੈ ਉਸ ਤੋਂ ਪਹਿਲਾਂ ਤੁਸੀਂ ਮਤਲਬ ਜਿਵੇਂ ਉਹ ਮੈਸ਼ ਪਟੈਟੋ ਜਿਹੜਾ ਤੁਹਾਨੂੰ ਦੱਸਿਆ ਸੀਗਾ ਉਹ ਕਰ ਲੀਓ ਜਾਂ ਓਟਸ ਓਟਸ ਖਾ ਲੀਓ ਤੁਸੀਂ ਹਾਂਜੀ ਅਤੇ ਬਾਕੀ ਤੁਹਾਨੂੰ ਆ ਕੇ ਦੱਸ ਦਾਂਗੇ ਜਦੋਂ ਤੁਸੀਂ ਆਉਂਗੇ ਹਾਂਜੀ ਵੀਰੇ ਇਹ ਆਪਣਾ ਸ਼ਿਮਲਾ ਪੁਰੀ ਹੈਗਾ ਪੰਜ ਨੰਬਰ ਗਲ਼ੀ

ਹਾਂਜੀ ਵੀਰੇ ਓਲਵੇਜ਼ ਅਵੇਅਰ ਓਕੇ ਵੀਰੇ ਓਕੇ ਓਲਵੇਜ਼ ਹੇਅਰ